ਹਾਂਜੀ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਰਦੀ ਦੀ ਸ਼ੁਰੂਆਤ ਹੋ ਚੁੱਕੀ ਹੈ ਇੱਥੇ ਸਵੇਰੇ ਥੋੜ੍ਹੀ ਜਿਹੀ ਠੰਡ ਅਤੇ ਸ਼ਾਮ ਨੂੰ ਥੋੜ੍ਹੀ ਜਿਹੀ ਜ਼ਿਆਦਾ ਠੰਡ ਮਹਿਸੂਸ ਹੋਣ ਲੱਗ ਪਈ ਹੈ ਦਿਨ ਥੋੜ੍ਹਾ ਵਧੀਆ ਜਾ ਰਿਹਾ ਹੈ ਕਿਉਂਕਿ ਦਿਨ ਵਿੱਚ ਕਈ ਵਾਰ ਧੁੱਪ ਨਿਕਲ ਜਾਂਦੀ ਹੈ ਅਤੇ ਕਈ ਵਾਰ ਬੱਦਲ ਬਾਈ ਛਾਈ ਰਹਿੰਦੀ ਹੈ ਹੁਣ ਇਸ ਸਮੇਂ 'ਤੇ ਕਣਕਾਂ ਦੀ ਕਟਾਈ ਵਗੈਰਾ ਕਣਕਾਂ ਝੋਨੇ ਦੀ ਕਟਾਈ ਵਗੈਰਾ ਦੇ ਨਾਲ ਧੂੰਆਂ ਉਹਨਾਂ ਦੀ ਫਸਲਾਂ ਨੂੰ ਸ ਸਾੜਨ ਨਾਲ ਧੂਆਂਧਾਰੀ ਨਾਲ ਮੌਸਮ ਥੋੜ੍ਹਾ ਖਰਾਬ ਜਿਹਾ ਲੱਗਦਾ ਹੈ ਠੰਡ ਘੱਟ ਹੁੰਦੀ ਹੈ ਪਰ ਮੌਸਮ ਕੁਸਮੁਸਾ ਜਿਹਾ ਬਣਿਆ ਰਹਿੰਦਾ ਹੈ ਹਾਂਜੀ ਅਸੀਂ ਗਰਮੀਆਂ ਅਤੇ ਕਸੋਕੇ ਅਤੇ ਕਠੋਰ ਸਨ ਸਰਦੀਆਂ ਦਾ ਅਨੁਭਵ ਕੀਤਾ ਹੈ ਕਿਉਂਕਿ ਇੱਥੇ ਗਰਮੀਆਂ ਦੇ ਵਿੱਚ ਕਠੋਰ ਗਰਮੀ ਪੈਂਦੀ ਹੈ ਅਤੇ ਸਰਦੀਆਂ ਦੇ ਵਿੱਚ ਸਰਦੀ ਵੀ ਕਾਫੀ ਪੈਂਦੀ ਹੈ ਕਿਉਂਕਿ ਇੱਥੇ ਇੱਕ ਛੋਟਾ ਜਿਹਾ ਸ਼ਹਿਰ ਹੈ ਹੁਣ ਪਿਛਲੇ ਸਾਲ ਹੀ ਸਰਦੀ ਬਹੁਤ ਜ਼ਿਆਦਾ ਪਈ ਬਹੁਤ ਜ਼ਿਆਦਾ ਧੁੰਦ ਹਨੇਰਾ ਸੀ ਸਰਦੀ ਪਿਛਲੇ ਸਾਲ ਇੰਨੀ ਕੁ ਜ਼ਿਆਦਾ ਸੀ ਕਿ ਉਹਨਾਂ ਦੇ ਨਾਲ ਬਜ਼ੁਰਗਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਬਜ਼ੁਰਗਾਂ ਦੇ ਨਾਲ ਨਾਲ ਜਵਾਨਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ ਜ਼ਿਆਦਾ ਸਰਦੀ ਨਾਲ ਫਸਲਾਂ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ ਕਈ ਬਜ਼ੁਰਗ ਵਿਚਾਰੇ ਤਾਂ ਠੰਡ ਦੇ ਕਾਰਨ ਮਰ ਹੀ ਗਏ ਸਨ ਕਈ ਸੜਕਾਂ ਦੇ ਉੱਤੇ ਜੋ ਲੋਕ ਬੈਠੇ ਹਨ ਜਿਹਨਾਂ ਕੋਲ ਕੋਈ ਘਰ ਕੋਈ ਛੱਤ ਜਾਂ ਕੋਈ ਬਿਸਤਰਾ ਨਹੀਂ ਹੈ ਉਹ ਠੰਡ ਦਾ ਸ਼ਿਕਾਰ ਹੋ ਗਏ ਹਨ ਅਤੇ ਜੋ ਛੋਟੇ ਛੋਟੇ ਬੱਚੇ ਹਨ ਉਹ ਵੀ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਪਏ ਸੀ ਅਤੇ ਉਹਨਾਂ ਦੇ ਇਲਾਜ ਲਈ ਹਸਪਤਾਲਾਂ ਵਿੱਚ ਭੱਜਣਾ ਪਿਆ ਸੀ ਅਨੁਭਵ ਮੇਰਾ ਇਹ ਰਿਹਾ ਜ਼ਿੰਦਗੀ ਦੇ ਦੌਰਾਨ ਮੌਸਮ ਵਿੱਚ ਹਰ ਤਬਦੀਲੀ ਹੁੰਦੀ ਵੇਖੀ ਹੈ ਕਦੇ ਗਰਮੀਆਂ ਬਹੁਤ ਜ਼ਿਆਦਾ ਕਦੇ ਸਰਦੀਆਂ ਬਹੁਤ ਜ਼ਿਆਦਾ ਜਦੋਂ ਕਦੇ ਬਰਸਾਤਾਂ ਨਹੀਂ ਹੁੰਦੀਆਂ ਤਾਂ ਸੋਕਾ ਵੀ ਪੈ ਜਾਂਦਾ ਹੈ ਇਸ ਨਾਲ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਸਾਡੇ ਲਈ ਬਹੁਤ ਕਈ ਵਾਰ ਸਹੀ ਸਾਬਿਤ ਨਹੀਂ ਹੁੰਦੀਆਂ